ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਕ੍ਰਿਸ਼ੀ ਵਿਗਿਆਨ ਜੀ ਬੀਜ ਬੀਜ ਭੰਡਾਰ ਤੋਂ ਬੋਲਦੇ ਜੀ ਹਾਂਜੀ ਜੀ ਤੁਹਾਨੂੰ ਕਿਹੜੀ ਹੁਣ ਜੀ ਸਰਦੀਆਂ ਦੀਆਂ ਫਸਲਾਂ ਦੇ ਜੀ ਬੀਜ ਤੁਹਾਨੂੰ ਉਥੇ ਮਿਲ ਜਾਣਗੇ ਜੀ ਬੀਜ ਤਾਂ ਆਪਣੇ ਕੋਲ ਹਰੇ ਕੁਆਲਿਟੀ ਦੇ ਹੈਗੇ ਜੀ ਅਤੇ ਕਿਹੜੇ ਕਿਹੜੇ ਜੀ ਤੁਹਾਨੂੰ ਮਿਲ ਜਾਣਗੇ ਜੀ ਕਪਾਹ ਪਾ ਦਾ ਮਿਲ ਜਾਵੇਗਾ ਜੀ ਤੁਹਾਨੂੰ ਅਤੇ ਬਾਜਰੇ ਦੇ ਜੀ ਜਵਾਰ ਦੇ ਜੀ ਅਤੇ ਮਟਰਾਂ ਹੋ ਗਈਆਂ ਜੀ ਹਾਂਜੀ ਹਾਂਜੀ ਕਣਕ ਦੇ ਵੀਰੇ ਰੇਟ ਸਰਕਾਰੀ ਰੇਟ ਜੀ ਸਾਨੂੰ ਸਰਕਾਰ ਨੇ ਉੱਪਰੋਂ ਸਾਨੂੰ ਲਿਸਟ ਭੇਜੀ ਹੁੰਦੀ ਹੈ ਜੀ ਉਹਦੇ ਹਿਸਾਬ ਨਾਲ ਰੇਟ ਲੱਗਦਾ ਜੀ ਅਤੇ ਉਹ ਤਾਂ ਤੁਸੀਂ ਜਿਹੜੇ ਤੁਹਾਨੂੰ ਬੀਜ ਲੈਣੇ ਆ ਤੁਸੀਂ ਇੱਥੇ ਆਓ ਇੱਥੇ ਦੇਖੋ ਕੁਆਲਿਟੀ ਇੱਥੇ ਜੀ ਅਸੀਂ ਬੀਜ ਸਾਰੇ ਬੀਜ ਉਗਾਏ ਵੀ ਹੁੰਦੇ ਆ ਕਿਉਂਕਿ ਸਾਨੂੰ ਤਾਂ ਜੀ ਕਿਸਾਨਾਂ ਨੂੰ ਦਿਖਾਉਣਾ ਵੀ ਪੈਂਦਾ ਜੀ ਅਤੇ ਆ ਸਾਡੇ ਵੀਰ ਦੀ ਕੁਆਲਿਟੀ ਕਿੱਦਾਂ ਦੀ ਆ ਤੁਸੀਂ ਆਓ ਆ ਕੇ ਦੇਖੋ ਇੱਕ ਵਾਰੀ ਨਹੀਂ ਜੀ ਨਹੀਂ ਜੀ ਬੀਜ ਤਾਂ ਤੁਹਾਨੂੰ ਜੀ ਤੁਸੀਂ ਜਦੋਂ ਵੀ ਆਓਗੇ ਜੀ ਵੀਰ ਤਾਂ ਬੀਜ ਭੰਡਾਰ ਦਾ ਕੰਮ ਹੀ ਇਹ ਹੈ ਜੀ ਅਤੇ ਆਓ ਇੱਥੇ ਅਤੇ ਬੀਜ ਲਓ ਇੱਥੋਂ ਹਾਂਜੀ ਕਿਹੜੇ ਏਰੀਆਂ ਤੋਂ ਜੀ ਤੁਸੀਂ ਅੱਛਾ ਜੀ ਅੱਛਾ ਠੀਕ ਠੀਕ ਠੀਕ ਜੀ ਹਾਂਜੀ ਹਾਂਜੀ ਅੱਜ ਤਾਂ ਜੀ ਪਾਣੀ ਫਸਲਾਂ ਵੀ ਆਪਾਂ ਉਦਾਂ ਦੀਆਂ ਉਗਾ ਸਕਦੇ ਜੀ ਘੱਟ ਪਾਣੀ ਆਲੀਆਂ ਕਿਉਂਕਿ ਅੱਜ ਕੱਲ੍ਹ ਪਾਣੀ ਦਾ ਪੱਧਰ ਵੀ ਬੜਾ ਘਟਿਆ ਪਿਆ ਜੀ ਪੰਜਾਬ ਦੇ ਵਿੱਚ ਤਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਤੁਸੀਂ ਆ ਕੇ ਜੀ ਇੱਕ ਵਾਰੀ ਇੱਥੇ ਬਾਕੀ ਸੈਮੀਨਾਰ ਵੀ ਲੱਗਦੇ ਤੁਸੀਂ ਇੱਕ ਵਾਰੀ ਸੈਮੀਨਾਰ ਵੀ ਅਟੈਂਡ ਕਰੋ ਉਹਨਾਂ 'ਚ ਤੁਹਾਨੂੰ ਪਤਾ ਚੱਲੇਗਾ ਜਾਣਕਾਰੀ ਮਿਲੇਗੀ ਪੂਰੀ ਕਿਹੜੀਆਂ ਕਿਹੜੀਆਂ ਫਸਲਾਂ ਤੁਹਾਨੂੰ ਕਰਨੀਆਂ ਚਾਹੀਦੀਆਂ ਤੁਸੀਂ ਇੱਥੋਂ ਫਿਰ ਬੀਜ ਲਜਾਇਓ ਜੀ ਅਤੇ ਬਾਕੀ ਵਿਚਾਰਾ ਜਾਣਕਾਰੀ ਤੁਹਾਨੂੰ ਇੱਥੇ ਆ ਕੇ ਹੀ ਮਿਲੇਗੀ ਸੈਮੀਨਾਰ ਜੀ ਤੁਸੀਂ ਏ ਜੀ ਪੰਦਰਾਂ ਤਰੀਕ ਨੂੰ ਲੱਗੇਗਾ ਜੀ ਹੁਣ

ਇਹ ਜੀ ਦਸ ਵਜੇ ਆ ਜਾਓ ਦਸ ਵਜੇ ਇੱਥੇ ਲੋਕ ਆ ਜਾਂਦੇ ਜੀ ਇਕੱਠੇ ਹੋ ਜਾਂਦੇ ਆ ਅਤੇ ਫਿਰ ਅਸੀਂ ਉਹਨਾਂ ਨੂੰ ਜਾਣਕਾਰੀ ਦੇ ਦਿੰਦੇ ਹਾਂ ਜੀ ਹਰੇਕ ਅਲੱਗ ਅਲੱਗ ਪੱਧਰ 'ਤੇ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ